ਭੰਗੜਾ ਪੰਜਾਬ ਦਾ ਇੱਕ ਲੋਕ ਨਾਚ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਹਰ ਖੁਸ਼ੀ ਵਿਆਹ ਦੇ ਮੌਕੇ 'ਤੇ ਇੱਕ ਮੇਨ ਪਾਰਟ ਅਦਾ ਕਰਦਾ ਹੈ ਪੰਜਾਬ ਵਿੱਚ ਸੱਭਿਆਚਾਰ ਦੇ ਪਹਿਲ ਦੇ ਆਧਾਰ 'ਤੇ ਭੰਗੜਾ ਪਾਇਆ ਜਾਂਦਾ ਹੈ ਸਕੂਲਾਂ ਕਾਲਜਾਂ ਵਿੱਚ ਜਦੋਂ ਵੀ ਫੈਸਟੀਵਲ ਤਿਉਹਾਰ ਆਉਂਦੇ ਹਨ ਤਾਂ ਭੰਗੜੇ ਦੀ ਕੋਈ ਨਾ ਕੋਈ ਆਈਟਮ ਜ਼ਰੂਰ ਰੱਖੀ ਜਾਂਦੀ ਹੈ ਭੰਗੜੇ ਦੇ ਸਟੈਪ ਵੱਖੋ ਵੱਖਰੇ ਹਨ ਜਿਵੇਂ ਕਿ ਹਾਥੀ ਚਾਲ ਫੁਲਕਾ ਧੰਧਾਰਾ ਹਾਥੀ ਚਾਲ ਮੋਰ ਚਾਲ ਧਮਾਲ ਤਾਰੀ ਫੁੱਲ ਮੱਤੀ ਚਾਲ ਝੂੰਮਰ ਆਦਿ ਭੰਗੜੇ ਨੂੰ ਕਈ ਤਰ੍ਹਾਂ ਦੀਆਂ ਸੁਰੰਗੀਆਂ ਨਾਲ ਵਜਾਇਆ ਜਾਂਦਾ ਹੈ ਜਾਂ ਪਾਇਆ ਜਾਂਦਾ ਹੈ ਢੋਲ ਬਾਂਸੁਰੀ ਕਾਟੋ ਦੀ ਵਰਤੋਂ ਕਰਕੇ ਅਸੀਂ ਭੰਗੜੇ ਨੂੰ ਹੋਰ ਵੀ ਜੋਸ਼ ਤਮਤਾਰ ਤਰੀਕੇ ਨਾਲ ਪਾ ਸਕਦੇ ਹਾਂ ਪੰਜਾਬ ਵਿੱਚ ਇਹ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ ਇਸ ਤੋਂ ਬਿਨਾਂ ਕੋਈ ਵੀ ਤਿਉਹਾਰ ਸਕੂਲਾਂ ਕਾਲਜਾਂ ਘਰਾਂ ਇਸ ਤੋਂ ਬਿਨਾਂ ਵਾਂਝਾ ਹੈ ਇਸ ਨਾਲ ਕਈ ਤਰ੍ਹਾਂ ਦੇ ਆਧੁਨਿਕ ਅਤੇ ਮਾਨਸਿਕ ਸਰੀਰਿਕ ਕਸ਼ਟ ਵੀ ਬਾਹਰ ਆਉਂਦੇ ਹਨ ਧੰਨਵਾਦ